ਹਾਂਜੀ ਮੈਂ ਜਾਣਦੀ ਹਾਂ ਮੇਰੇ ਇੱਕ ਬੜੇ ਹੀ ਨੇੜਲੇ ਰਿਸ਼ਤੇਦਾਰ ਹਨ ਉਹਨਾਂ ਦੇ ਬੇਟੇ ਦੇ ਕੋਲ ਡੀ ਫਾਰਮੇਸੀ ਦੀ ਉਹਨਾਂ ਨੇ ਡਿਪਲੋਮਾ ਕੀਤਾ ਹੈ ਅਤੇ ਇਸ ਡਿਪਲੋਮੇ ਨੂੰ ਕਰਕੇ ਉਸ ਨੂੰ ਬੱਚੇ ਨੂੰ ਆਪ ਨੂੰ ਵੀ ਬਹੁਤ ਵਧੀਆ ਲੱਗਾ ਇੱਕ ਤਾਂ ਉਹਨੇ ਆਪਣੀ ਦਵਾਈਆਂ ਦੀ ਦੁਕਾਨ ਵੀ ਪਾ ਲਈ ਹੈ ਉਸਦਾ ਰੁਜ਼ਗਾਰ ਦਾ ਸਾਧਨ ਵੀ ਬਣ ਗਿਆ ਹੈ ਪਰ ਇਹਦੇ ਨਾਲ ਨਾਲ ਜਦੋਂ ਵੀ ਉਹਦੀ ਦੁਕਾਨ 'ਤੇ ਕੋਈ ਮੈਡੀਸਨ ਲੈਣ ਲਈ ਆਉਂਦਾ ਹੈ ਦਵਾਈ ਲੈਣ ਲਈ ਆਉਂਦਾ ਹੈ ਅਤੇ ਉਹ ਉਹਨਾਂ ਨੂੰ ਹੋਰ ਚੰਗੀ ਤਰ੍ਹਾਂ ਗਾਈਡ ਕਰ ਦਿੰਦਾ ਹੈ ਉਸ ਦਵਾਈ ਦੇ ਸਾਲਟ ਦੇ ਬਾਰੇ ਵੀ ਕਿ ਇਹ ਕਿੰਨਾਂ ਕੁ ਚੰਗਾ ਹੈ ਬੋਡੀ ਵਾਸਤੇ ਜਾਂ ਕਿਵੇਂ ਦਾ ਹੈ ਸਾਰਾ ਬੜੀ ਚੰਗੀ ਸੋਚ ਚੰਗੀ ਸੋਚ ਦ ਰੱਖਦੇ ਹੋਏ ਦਵਾਈਆਂ ਦੇ ਸਾਈਡ ਇਫੈਕਟ ਕੀ ਹਨ ਇੱਕ ਤੁਹਾਡੇ 'ਤੇ ਹੈ ਸਹੀ ਹੈ ਜਾਂ ਨਹੀਂ ਹੈ ਇਸ ਬਾਰੇ ਵੀ ਦੂਜੇ ਨੂੰ ਜਾਣਕਾਰੀ ਦੇ ਦਿੰਦਾ ਹੈ ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਬੱਚੇ ਨੇ ਇਹ ਜੋ ਡੀ ਫਾਰਮੇਸੀ ਦੀ ਜਿਹੜੀ ਡਿਪਲੋਮਾ ਕੀਤਾ ਹੈ ਤਾਂ ਉਹ ਉਹਨੇ ਆਪਣੇ ਆਪਣੇ ਰੁਜ਼ਗਾਰ ਦੇ ਨਾਲ ਨਾਲ ਉਹ ਦੂਜਿਆਂ ਦੀ ਭਲਾਈ ਦਾ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ